ਹੁਕਮੈ ਅੰਦਰਿ ਸਭੁ ਕੇ ਬਾਹਰਿ ਹੁਕਮ ਨ ਕੋਇ ਨਾਨਕ ਹੁਕਮੈ ਜੇ ਕੁ ਬੁਝੈ ਤਾਂ ਹਉਮੈ ਕਹੈ ਨ ਕੋਇ ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਲੇਖਾ ਰਬੁ ਮੰਗੇਸੀਆ ਤੂੰ ਆਹੋ ਕੇਰ੍ਹੇ ਕੰਮਿ ਸਾਧੂ ਸਾਧ ਸਰਨੀ ਮਿਲੀ ਸੰਗਤ ਜੀਤੂ ਹਰੀ ਰਸੂ ਕਾਡੀਏ ਕਡੀਏ ਪਰਉਪਕਾਰ ਬੋਲ ਹੀ ਬਹੂ ਗੁਣਿਆ ਮੁਖੀ ਸੰਤ ਭਗਤ ਹਰੀ ਦੀਜੇ ਮੇਰਾ ਮਨ ਆਸਿਆ ਉਪਗਲਾ ਉਲਾਨਾ ਹਰੀ ਹਰਿ ਆਣੀ ਮਿਲਾਓ ਗੁਰੂ ਸਾਧੂ ਮਿਲੀ ਸਾਧੂ ਕਪਟ ਖੁਲਾਨਾ ਦਿਲ ਦੇ ਸੱਚੇ ਲੋਕ ਬੇਸ਼ੱਕ ਹੀ ਇਕੱਲੇ ਰਹਿ ਜਾਣ ਪਰ ਪ੍ਰਮਾਤਮਾ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਹਨ ਬੁਰੇ ਕਾਮ ਕਉ ਊਠਿ ਖਲੋਇਆ ਨਾਮ ਕੀ ਬੇਲਾ ਪੇ ਪੇ ਸੋਇਆ ਇੱਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ ਜੋ ਚੀਜ਼ ਕਿਸਮਤ ਵਿੱਚ ਨਹੀਂ ਉਹਦੀ ਇੱਛਾ ਮਨ ਵਿੱਚ ਨਾ ਜਗਾਈਂ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਕੋਈ ਹੋਰ ਵਿਅਕਤੀ ਵਿਸ਼ੇਸ਼ ਆਪਣੇ ਰਾਜਨੀਤਿਕ ਜਾਂ ਕਿਸੇ ਵੀ ਪ੍ਰਕਾਰ ਦੇ ਕੰਮ ਲਈ ਸ਼ੁਭ ਸ਼ੁਭਦੀਪ ਸਿੰਘ ਦਾ ਨਾਂ ਕਿਰਪਾ ਕਰਕੇ ਨਾ ਵਰਤਿਆ ਜਾਵੇ